ਭਾਰਤ ਵਿੱਚ ਗੱਲ ਕੀਤੀ ਜਾਵੇ ਤਾਂ ਮੇਰਾ ਮਨਪਸੰਦ ਰਾਜ ਆਪਣਾ ਪੰਜਾਬ ਹੀ ਹੈ ਅਤੇ ਅਗਰ ਗੱਲ ਕੀਤੀ ਜਾਵੇ ਕਿ ਕਿਉਂ ਤਾਂ ਪੰਜਾਬ ਵਰਗਾ ਸੱਭਿਆਚਾਰ ਅਤੇ ਹਸਮੁਖ ਲੋਕ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਜਗ੍ਹਾ ਮਤਲਬ ਭਾਰਤ ਵਿੱਚ ਹੈਗੇ ਆ ਅਤੇ ਭਾਰਤ ਵਿੱਚ ਜਿਵੇਂ ਤਾਂ ਗੱਲ ਆਉਂਦੀ ਹੈ ਕਿ ਘੁੰਮਣਾ ਕਿੱਥੇ ਚਾਹੋਗੇ ਤਾਂ ਮੈਂ ਪਹਿਲਾਂ ਤਾਂ ਮਤਲਬ ਪੰਜਾਬ ਹੀ ਆਪਣਾ ਪੂਰਾ ਘੁੰਮਣਾ ਚਾਹੁੰਗਾ ਕਿਉਂਕਿ ਮੈਂ ਪੰਜਾਬ ਵੀ ਇੰਨਾਂ ਘੁੰਮਿਆ ਨਹੀਂ ਹੈਗਾ ਮੈਂ ਗਿਆ ਹੈਗਾ ਤਾਂ ਇਹ ਪਠਾਨਕੋਟ ਜਲੰਧਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਇਲਾਵਾ ਮੈਨੂੰ ਨਹੀਂ ਲੱਗਦਾ ਮੈਂ ਕਿਤੇ ਮਤਲਬ ਜ਼ਿਆਦਾ ਘੁੰਮਿਆ ਜਾਂ ਜ਼ਿਆਦਾ ਉੱਥੇ ਦਾ ਸੱਭਿਆਚਾਰ ਜਾਂ ਕਲਚਰ ਐਕਸਪਲੋਰ ਕੀਤਾ ਅਤੇ ਲਾਈਫ ਸਟਾਈਲ ਅਤੇ ਲੈਂਗੂਏਜ ਐਕਸਪਲੋਰ ਕੀਤੀ ਹੈ ਅਤੇ ਜ਼ਰੂਰੀ ਇਹੀ ਹੁੰਦਾ ਕਿ ਮਤਲਬ ਜਦੋਂ ਵੀ ਸ਼ੁਰੂਆਤ ਕਰਦੇ ਹਾਂ ਆਪਣੇ ਘਰ ਤੋਂ ਕਰੀਏ ਤਾਂ ਮੇਰਾ ਮੰਨਣਾ ਇਹੀ ਹੈ ਕਿ ਮੈਂ ਪਹਿਲਾਂ ਪੰਜਾਬ ਘੁੰਮਾਂ ਆਪਣਾ ਪੰਜਾਬ ਪੰਜਾਬ ਦਾ ਸੱਭਿਆਚਾਰ ਦੇਖਾਂ ਵੱਖ ਵੱਖ ਬੋਲੀ ਬੋਲੀਆਂ ਸੁਣਾ ਅਤੇ ਉਹਨਾਂ ਤੋਂ ਸਮਝਾਂ ਅਤੇ ਉਹਨਾਂ ਨੂੰ ਅੱਗੇ ਮਤਲਬ ਉਹਨਾਂ ਦਾ ਪ੍ਰਚਾਰ ਕਰਾਂ ਅਤੇ ਉਹਨਾਂ ਨੂੰ ਅੱਗੇ ਤੋਂ ਸਿੱਖ ਸਿੱਖਿਆ ਲਵਾਂ ਅਤੇ ਕੁਛ ਵਧੀਆ ਕਰਾਂ ਜ਼ਿੰਦਗੀ 'ਚ